ਅੱਜ ਦੇ ਸਮੇਂ ਵਿੱਚ ਮੈਂ ਗੂਗਲ ਪੇਅ ਦੀ ਵਰਤੋਂ ਕਰਦਾ ਹਾਂ ਇਸ ਵਿੱਚ ਕੋਈ ਘਾਟ ਨਜ਼ਰ ਨਹੀਂ ਆਈ ਭਰੋਸੇਯੋਗ ਹੈ ਅਤੇ ਸੁਰੱਖਿਤ ਤਰੀਕਾ ਹੈ